ਯੋਗ ਆਸਨ ਅੱਜ ਆਧੁਨਿਕ ਦੇ ਯੁੱਗ ਵਿੱਚ ਅਸੀਂ ਯੋਗਾ ਆਸਨ ਅਤੇ ਮਾਧਿਅਮ ਨਾਲ ਸਰੀਰਕ ਮਾਨਸਿਕ ਬਿਮਾਰੀਆਂ ਤੋਂ ਛੁਟਕਾਰਾ ਆਸਾਨੀ ਨਾਲ ਪਾ ਸਕਦੇ ਹਾਂ ਇਸ ਲਈ ਸਾਨੂੰ ਯੋਗਾ ਰੋਜ਼ਾਨਾ ਕਰਨਾ ਚਾਹੀਦਾ ਹੈ ਲਗਾਤਾਰ ਯੋਗਾ ਕਰਨ ਨਾਲ ਤੁਸੀਂ ਆਪਣੇ ਸਰੀਰ ਅਤੇ ਮਨ ਦੋਵਾਂ ਨੂੰ ਸਿਹਤਮੰਦ ਰੱਖ ਸਕਦੇ ਹੋ ਅੱਜ ਦੀ ਪਹਾੜੀ ਜ਼ਿੰਦਗੀ ਹਰ ਕਿਸੇ ਦੇ ਤਨਾਅ ਦਾ ਕਾਰਨ ਬਣ ਰਹੀ ਹੈ ਜਿਸ ਕਾਰਨ ਸਰੀਰ ਹਜ਼ਾਰਾਂ ਬਿਮਾਰੀਆਂ ਦਾ ਸ਼ਿਕਾਰ ਹੋ ਰਿਹਾ ਹੈ ਯੋਗ ਪ੍ਰਾਚੀਨ ਭਾਰਤ ਦਾ ਇੱਕ ਸਰੀਰਕ ਅਤੇ ਮਾਨਸਿਕ ਅਭਿਆਸ ਹੈ ਜੋ ਸਰੀਰ ਨੂੰ ਤਾਕਤ ਦਿੰਦਾ ਹੈ ਅਤੇ ਮਨ ਦੀ ਇਕਾਗਰਤਾ ਨੂੰ ਵਧਾਉਂਦਾ ਹੈ ਯੋਗਾ ਵਿੱਚ ਕੀਤੇ ਜਾਣ ਵਾਲੇ ਆਸਨਾਂ ਨੂੰ ਯੋਗ ਆਸਨ ਕਿਹਾ ਜਾਂਦਾ ਹੈ ਜੋ ਸਰੀਰਕ ਆਸਨ ਹਨ ਜੋ ਨਿਯਮਤ ਤੌਰ 'ਤੇ ਅਭਿਆਸ ਕਰਨ ਨਾਲ ਸਰੀਰ ਵਿੱਚ ਲਚਕਤਾ ਅਤੇ ਤਾਕਤ ਵਧਾਉਂਦੇ ਹਨ ਅੱਜ ਦੇ ਸਮੇਂ ਵਿੱਚ ਯੋਗਾ ਪੂਰੀ ਦੁਨੀਆਂ ਵਿੱਚ ਪ੍ਰਸਿੱਧ ਹੈ ਰੋਜ਼ਾਨਾ ਯੋਗਾ ਕਰਨ ਨਾਲ ਮਾਨਸਿਕ ਅਤੇ ਸਰੀਰਕ ਸਿਹਤ ਦੇ ਸੁਧਾਰ ਹੁੰਦਾ ਹੈ ਸਾਡੇ ਵਿੱਚ ਸਕਾਰਤਮਕ ਊਰਜਾ ਵਧਦੀ ਹੈ ਅਤੇ ਨਕਾਰਤਮਕ ਭਾਵਨਾਵਾਂ ਘੱਟ ਹੁੰਦੀਆਂ ਹਨ ਮਾਨਸਿਕ ਸਿਹਤ ਵਿੱਚ ਚੰਗੀ ਹੋਣ ਕਰਕੇ ਤੁਸੀਂ ਫਿੱਟ ਰਹਿੰਦੇ ਹੋ ਪਰ ਯੋਗਾ ਕਰਨ ਲਈ ਸਹੀ ਸਮੇਂ ਅਤੇ ਸਹੀ ਸਥਾਨ ਚੁਣੋ ਆਓ ਜਾਣਦੇ ਹਾਂ ਕਿ ਅਸੀਂ ਯੋਗਾ ਕਰਦੇ ਸਮੇਂ ਕਿਹੜੀਆਂ ਅਹਿਮ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਇਹ ਵਧੇਰੇ ਚੁਣੌਤੀਪੂਰਨ ਪੌਜਾਂ ਦੇ ਵਿਚਕਾਰ ਆਰਾਮ ਦਾ ਇੱਕ ਪਲ ਵੀ ਪ੍ਰਦਾਨ ਕਰਦਾ ਹੈ ਜੋ ਅਜੇ ਵੀ ਰੁਝੇਵਿਆਂ ਨੂੰ ਬਰਕਰਾਰ ਰੱਖਦੇ ਹੋਏ ਥੋੜ੍ਹੇ ਸਮੇਂ ਲਈ ਆਰਾਮ ਦੀ ਆਗਿਆ ਦਿੰਦਾ ਹੈ ਖਿੱਚਣ ਮਜ਼ਬੂਤੀ ਅਤੇ ਪੁਨਰ ਸਥਾਪਿਤ ਕਰਨ ਵਾਲੇ ਗੁਣਾਂ ਦਾ ਪੌਜ ਸੰਤੁਲਨ ਵੱਖ ਵੱਖ ਹੁਨਰਾਂ ਪੱਧਰਾਂ ਲਈ ਇਸਦੀ ਪਹੁੰਚ ਯੋਗਤਾ ਦੇ ਨਾਲ ਇਸ ਨੂੰ ਕਈ ਯੋਗਾ ਅਭਿਆਸਾਂ ਦਾ ਕੇਂਦਰੀ ਹਿੱਸਾ ਬਣਾਉਂਦਾ ਹੈ ਇਸਦੀ ਸਾਦਗੀ ਅਤੇ ਪ੍ਰਭਾਵ ਯੋਗਾ ਦੀ ਸਰੀਰ ਮਨ ਅਤੇ ਆਤਮਾ ਨੂੰ ਇੱਕ ਸੂਰਤਾ ਪੂਰਵਕ ਤਰੀਕੇ ਨਾਲ ਏਕੀਕ੍ਰਿਤ ਕਰਨ ਦੀ ਯੋਗਤਾ ਦਾ ਸਾਰ ਦਰਸਾਉਂਦਾ ਹੈ ਜੋ ਸਰੀਰਕ ਆਸਨ ਹਨ ਜੋ ਨਿਯਮਤ ਤੌਰ 'ਤੇ ਅਭਿਆਸ ਕਰਨ ਲਈ ਸਾਡੇ ਸਰੀਰ ਵਿੱਚ ਲਚਕਤਾ ਅਤੇ ਤਾਕਤ ਵਧਾਉਂਦੇ ਹਨ